ਹੈਲੋ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ

ਹੈਲੋ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ

ਹਾਂਜੀ ਦੱਸੋ ਕਰ ਲੈਂਦੇ ਹਾਂ ਹਾਂਜੀ ਹੈਗਾ ਹਾਂਜੀ ਵੈਸੇ ਹੀ ਜਾਣ ਪਛਾਣ ਦਾ ਹਾਂਜੀ ਹਾਂਜੀ ਕਰ ਦਊਂਗਾ ਕਰ ਦਊ ਮਿੱਟੀ ਵਾਲਾ ਵੀ ਹੈਗਾ

ਹਾਂਜੀ ਸਕੂਟਰੀ ਬਾਈਕ ਚਲਾਉਣ 'ਚ ਵੀ ਦਿੱਕਤ ਆਉਂਦੀ ਆ ਹਾਂਜੀ ਹਾਂਜੀ ਹਾਂਜੀ ਅਤੇ ਕੀ ਪੈਸੇ ਲੈਂਦੇ ਹੋ ਪੈਸੇ ਕਿੱਥੋਂ ਲੈਣੇ